ਅੱਜ ਦੇ ਭਾਰਤ ਵਿੱਚ ਸਭ ਤੋਂ ਵੱਡੀ ਚੁਣੌਤੀ ਹੈ ਪ੍ਰਵਾਸ ਫਸਟ ਔਫ ਔਲ ਆਪਾਂ ਗੱਲ ਕਰਦੇ ਹਾਂ ਕਿ ਪ੍ਰਵਾਸ ਹੁੰਦਾ ਕੀ ਆ ਠੀਕ ਆ ਪ੍ਰਵਾਸ ਹੁੰਦਾ ਜਦੋਂ ਕੋਈ ਵੀ ਵਿਅਕਤੀ ਇੱਕ ਸਥਾਨ ਛੱਡ ਕੇ ਦੂਜੇ ਸਥਾਨ 'ਤੇ ਚਲਿਆ ਜਾਂਦਾ ਉਹਨੂੰ ਪ੍ਰਵਾਸ ਕਹਿੰਦੇ ਹੈ ਅਤੇ ਭਾਰਤ ਵਿੱਚ ਪ੍ਰਵਾਸ ਜਿਹੜਾ ਲਗਾਤਾਰ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ ਲੋਕ ਭਾਰੀ ਮਾਤਰਾ ਵਿੱਚ ਲੋਕ ਅਤੇ ਵਿਦਿਆਰਥੀ ਭਾਰੀ ਮਾਤਰਾ ਵਿੱਚ ਵੱਡੀ ਗਿਣਤੀ ਵਿੱਚ ਆਪਣਾ ਦੇਸ਼ ਛੱਡ ਕੇ ਬਾਹਰਲੀਆਂ ਕੰਟਰੀਆਂ 'ਚ ਜਾ ਰਹੇ ਆਂ ਠੀਕ ਆ ਹੁਣ ਇਹਦਾ ਕਾਰਨ ਕੀ ਆ ਪ੍ਰਵਾਸ ਦੇ ਕਾਰਨ ਕੀ ਆ ਪਹਿਲਾਂ ਤਾਂ ਹੈਗਾ ਹੈ ਕਿ ਹੈ ਨਾ ਰੁਜ਼ਗਾਰ ਰੁਜ਼ਗਾਰ ਆ ਜਿਹੜਾ ਪ੍ਰਵਾਸ ਦਾ ਮੁੱਖ ਕਾਰਨ ਹੈ ਠੀਕ ਹੈ ਜਿਹੜੇ ਲੋਕ ਆ ਰੁਜ਼ਗਾਰ ਦੀ ਭਾਲ ਵਿੱਚ ਪ੍ਰਵਾਸ ਕਰ ਰਹੇ ਆ ਵਿਦੇਸ਼ਾਂ ਵੱਲ ਜਾ ਰਹੇ ਹੈ ਠੀਕ ਆ ਜਿਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਵੱਡੀ ਗਿਣਤੀ ਨੌਜਵਾਨਾਂ ਦੀ ਹੈ ਜਦ ਲੋੋ ਜਿਹੜੇ ਲੋਕਾਂ ਨੂੰ ਨਾ ਆਪਣੇ ਦੇਸ਼ ਵਿੱਚ ਰੁਜ਼ਗਾਰ ਨਹੀਂ ਮਿਲਦਾ ਹੈਗਾ ਜਾਂ ਉਹਨਾਂ ਨੂੰ ਆਪਣੀ ਮਿਹਨਤ ਦਾ ਸਹੀ ਮੁੱਲ ਨਹੀਂ ਮਿਲਦਾ ਹੈਗਾ ਠੀਕ ਹੈ ਤਾਂ ਉਹ ਵਿਦੇਸ਼ਾਂ ਵੱਲ ਅਕਰਸ਼ਕ ਹੁੰਦੇ ਆ ਜਿਹਦੇ ਕਰਕੇ ਜਿਹੜਾ ਦਿਨ ਪ੍ਰਤੀ ਦਿਨ ਆ ਪ੍ਰਵਾਸ ਵੱਧਦਾ ਜਾ ਰਿਹਾ ਸੈਕਿੰਡ ਆਉਂਦਾ ਹੈ ਕਿ ਸਹੂਲਤਾਂ ਹੈ ਨਾ ਬਾਹਰਲੇ ਦੇਸ਼ਾਂ ਵਿੱਚ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮਿਲਦੀਆਂ ਨੇ ਠੀਕ ਆ ਆਪਣੇ ਦੇਸ਼ਾਂ ਵਿੱਚ ਜਦੋਂ ਉਹਨਾਂ ਨੂੰ ਸਹੂਲਤਾਂ ਪੂਰੀਆਂ ਨਹੀਂ ਮਿਲਦੀਆਂ ਹੈਗੀਆਂ ਠੀਕ ਆ ਜਾਂ ਉਹਨਾਂ ਨੂੰ ਇੱਥੇ ਦੀਆਂ ਸਹੂਲਤਾਂ ਪਸੰਦ ਨਹੀਂ ਆਉਂਦੀਆਂ ਘਟੀਆ ਲੱਗਦੀਆਂ ਤਾਂ ਉਹ ਵੱਡੀ ਮਾਤਰਾ ਵਿੱਚ ਹੈ ਨਾ ਬਾਹਰਲੀਆਂ ਸਹੂਲਤਾਂ ਤੋਂ ਪ੍ਰੇਰਿਤ ਹੋ ਕੇ ਬਾਹਰ ਦੇ ਦੇਸ਼ਾਂ ਵੱਲ ਜਾਂਦੇ ਆ ਐਸ਼ੋ ਅਰਾਮ ਦਾ ਸੁਪਨਾ ਤਾਂ ਹਰ ਇੱਕ ਦਾ ਜੀਵਨ ਹੁੰਦਾ ਐਸ਼ੋ ਅਰਾਮ ਦਾ ਜੀਵਨ ਬਤੀਤ ਕਰਨਾ ਤਾਂ ਹਰ ਇੱਕ ਦਾ ਸੁਪਨਾ ਹੁੰਦਾ ਹੈ ਠੀਕ ਹੈ ਇਹੀ ਕਾਰਨ ਆ ਕਿ ਜਿਹੜੇ ਲੋਕ ਆ ਪ੍ਰਵਾਸ ਕਰ ਰਹੇ ਆ ਠੀਕ ਆ ਉਹ ਤੋਂ ਬਾਅਦ ਆਉਂਦਾ ਪੜ੍ਹਾਈ ਜਿਹੜੇ ਵਿਦਿਆਰਥੀ ਆ ਵੱਡੀ ਮਾਤਰਾ ਵਿੱਚ ਬਾਹਰਲੇ ਦੇਸ਼ਾਂ ਵਿੱਚ ਜਾ ਰਹੇ ਆਂ ਕਿਉਂ ਕਿਉਂਕਿ ਭਾਰਤ ਦਾ ਜਿਹੜਾ ਵੀ ਹੈ ਨਾ ਵਿੱਦਿਆ ਦਾ ਢਾਂਚਾ ਉਹ ਸਹੀ ਨਹੀਂ ਹੈਗਾ ਠੀਕ ਆ ਇੰਨੇ ਇੰਨੇ ਸਾਲਾਂ ਤੋਂ ਉਹੀ ਟੋਪਿਕ ਉਹੀ ਸਿਲੇਬਸ ਉਹੀ ਰਿਵੀਜ਼ਨ ਸਭ ਉਹੀ ਬੁੱਕਸ ਉਹੀ ਸਭ ਕੁਛ ਕ ਚਲਦਾ ਆ ਰਿਹਾ ਠੀਕ ਆ ਅਤੇ ਹਰ ਇੱਕ ਦਾ ਸੁਪਨਾ ਹੁੰਦਾ ਕਿ ਪੜ੍ਹ ਲਿਖ ਕੇ ਆਪਣੀ ਜਿਹੜੀ ਲਾਈਫ ਆ ਉਹਨੂੰ ਸਫਲ ਕਰ ਸਕੇ ਤਾਂ ਕਰਕੇ ਜਿਹੜੇ ਵਿਦਿਆਰਥੀਆਂ ਵਿਦੇਸ਼ਾਂ ਵੱਲ ਜਾ ਰਹੀ ਆਂ ਹੈ ਨਾ ਉਹ ਤੋਂ ਬਾਅਦ ਆਉਂਦਾ ਦੇਖਾ ਦੇਖੀ ਹੁਣ ਜਿਵੇਂ ਆਂਢ ਗੁਆਂਢ 'ਚ ਲੋਕ ਜਾਂਦੇ ਆ ਹੈ ਨਾ ਇੱਕ ਦੂਜੇ ਨੂੰ ਦੇਖਦੇ ਹੈ ਕਿ ਹੈ ਨਾ ਫਲਾਣੇ ਦਾ ਮੁੰਡਾ ਬਾਹਰ ਗਿਆ ਜਾਂ ਢਮਕਾਣੇ ਦੀ ਕੁੜੀ ਬਾਹਰ ਗਈ ਉਹਨਾਂ ਤੋਂ ਪ੍ਰੇਰਿਤ ਹੋ ਕੇ ਜਾਂ ਉਹਨਾਂ ਦਾ ਜੀਵਨ ਸਫਲ ਹੁੰਦਾ ਦੇਖ ਕੇ ਉਹ ਵੀ ਪ੍ਰੇਰਿਤ ਹੁੰਦੇ ਆ ਉਹ ਵੀ ਚਾਹੁੰਦਾ ਕਿ ਅਸੀਂ ਬਾਹਰ ਜਾ ਕੇ ਆਪਣਾ ਜੀਵਨ ਸਫਲ ਕਰੀਏ ਹੈ ਨਾ ਬਾਹਰ ਜਾਂਦੇ ਹੈ ਤਾਂ ਬਾਹਰ ਜਾਣ ਵੱਲ ਪ੍ਰੇਰਿਤ ਹੁੰਦਾ ਉਹ ਤੋਂ ਬਾਅਦ ਕਈ ਵਾਰ ਧੱਕਾ ਹੁਣ ਜਿਵੇਂ ਆਂਢ ਗਵਾਂਢ 'ਚ ਹੁੰਦਾ ਹੈ ਜਾਂ ਮਾਤਾ ਪਿਤਾ ਸਭ ਦੇ ਹੁੰਦੇ ਆ ਉਹ ਦੇਖਦੇ ਆ ਕਿ ਕਿਸੇ ਦਾ ਬੱਚਾ ਉਹ ਬਾਹਰ ਜਾ ਕੇ ਬਹੁਤ ਵਧੀਆ ਪੜ੍ਹਿਆ ਲਿਖਿਆ ਜਾਂ ਕਿਸੇ ਉੱਚੇ ਸਥਾਨ 'ਤੇ ਬੈਠਾ ਹੈ ਜਾਂ ਕਿਸੇ ਉੱਚੇ ਪਦਵੀ 'ਤੇ ਬੈਠਾ ਉਹਦਾ ਸਟੇਟਸ ਹਾਈ ਆ ਸੋਸਾਈਟੀ 'ਚ ਤਾਂ ਘਰ ਦੇ ਧੱਕਾ ਕਰਦੇ ਆ ਜਾਂ ਫਿਰ ਕਈ ਵਾਰ ਕੀ ਹੁੰਦਾ ਹੈ ਕਿ ਹੈ ਨਾ ਆਪਣੇ ਦੇਸ਼ 'ਚ ਜਾਂ ਆਪਣੇ ਘਰ ਕੋਈ ਸਿਕਿਓਰ ਫੀਲ ਨਹੀਂ ਕਰਦਾ ਹੈਗਾ ਹੈ ਨਾ ਇਨਸਿਕਿਓਰ ਹੋ ਜਾਂਦਾ ਹੈ ਤਾਂ ਕਰਕੇ ਜਿਹੜੇ ਲੋਕ ਬਾਹਰ ਜਾਂਦੇ ਆ ਹੁਣ ਪ੍ਰਵਾਸ ਦੇ ਨੁਕਸਾਨ ਕੀ ਆ ਪਹਿਲਾ ਤਾਂ ਆਉਂਦਾ ਹੈ ਹੈ ਨਾ ਭਾਰੀ ਮਾਤਰਾ ਵਿੱਚ ਜਿਹੜਾ ਪੈਸਾ ਹੈ ਉਹ ਵਿਦੇਸ਼ਾਂ ਵੱਲ ਜਾ ਰਿਹਾ ਹੈ ਤਾਂ ਕਰਕੇ ਜਿਹੜਾ ਇੰਡੀਆ ਉਹਦੀ ਆਰਥਿਕ ਹਾਲਤ ਮਾੜੀ ਹੁੰਦੀ ਜਾ ਰਹੀ ਆ ਠੀਕ ਆ ਉਹ ਤੋਂ ਬਾਅਦ ਉਹਦਾ ਸੱਭਿਆਚਾਰ ਨੂੰ ਘਾਟਾ ਪੈ ਰਿਹਾ ਹੈ ਜਿਹੜਾ ਸੱਭਿਆਚਾਰ ਉਹ ਦਿਨ ਪ੍ਰਤੀ ਦਿਨ ਘੱਟਦਾ ਜਾ ਰਿਹਾ ਅਲੋਪ ਹੁੰਦਾ ਜਾ ਰਿਹਾ ਲੋਕ ਵਿਦੇਸ਼ਾਂ ਵੱਲ ਜਾ ਰਹੇ ਅਤੇ ਉੱਥੋਂ ਦਾ ਸੱਭਿਆਚਾਰ ਅਪਣਾ ਰਹੇ ਆ ਪੰਜਾਬੀ ਸੱਭਿਆਚਾਰ ਨੂੰ ਸਭ ਲੋਕ ਭੁੱਲਦੇ ਜਾ ਰਹੇ ਆ ਠੀਕ ਆ ਉਹ ਤੋਂ ਬਾਅਦ ਸੰਯੁਕਤ ਪਰਿਵਾਰ ਟੁੱਟ ਰਹੇ ਆਂ ਠੀਕ ਆ ਪਰਿਵਾਰਾਂ ਵਿੱਚ ਫਿੱਕ ਪੈ ਰਹੀ ਆ ਲੋਕ ਆਪਣੇ ਪਰਿਵਾਰ ਛੱਡ ਕੇ ਹੈ ਨਾ ਇਕੱਲੇ ਰਹਿਣਾ ਪਸੰਦ ਕਰਦੇ ਆ ਕੋਈ ਆਪਣੀ ਫੈਮਿਲੀ ਨਾਲ ਰਹਿਣਾ ਪਸੰਦ ਨਹੀਂ ਕਰਦਾ ਹੈਗਾ ਸਭ ਆਪਣੀ ਫੈਮਲੀ ਛੱਡ ਕੇ ਬਾਹਰ ਚਲੇ ਜਾਂਦੇ ਆ ਹੈ ਨਾ ਜਿਹੜੇ ਵੀ ਪੰਜਾਬ 'ਚ ਹੈ ਨਾ ਮਤਲਬ ਹਾਈ ਸਟੇਟਸ ਲੋਕ ਬੈਠੇ ਆ ਜਾਂ ਹਾਈ ਉਹ 'ਤੇ ਬੈਠੇ ਆ ਪਦਵੀਆਂ ਉੱਚੇ ਪਦਵੀਆਂ 'ਤੇ ਬੈਠੇ ਆ ਠੀਕ ਆ ਉਹ 'ਤੇ ਪੰਜਾਬ ਦੇ ਜਾਂ ਇੰਡੀਆ ਦਾ ਕੋਈ ਲੋਕ ਹੈ ਹੀ ਨਹੀਂ ਸਭ ਬਾਹਰਲੇ ਬਾਹਰਲੇ ਦੇਸ਼ਾਂ ਤੋਂ ਆਏ ਹੋਏ ਆ ਠੀਕ ਆ ਜਾਂ ਉਹ ਅਦਰ ਸਟੇਟਸ ਤੋਂ ਆਏ ਹੋਏ ਆ ਤਾਂ ਕਰਕੇ ਜਿਹੜਾ ਆਪਣੇ ਲੋਕਾਂ ਬਾਰੇ ਸੋਚਦੇ ਆ ਸੋ